ਡੇਂਗੂ ਬੁਖਾਰ ਅਤੇ ਮਲੇਰੀਆ ਮੱਛਰਾਂ ਤੋਂ ਹੋਣ ਵਾਲੀਆਂ ਕਾਮਨ ਬਿਮਾਰੀਆਂ ਹਨ ਇਹਨਾਂ ਤੋਂ ਬਚਾਅ ਕਰਨ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਮੱਛਰਾਂ ਦੇ ਕੱਟਣ ਤੋਂ ਬਚਾਈਏ ਜ਼ਰੂਰੀ ਹੈ ਕਿ ਅਸੀਂ ਪੂਰੀ ਬਾਜੂ ਦੇ ਦੀਆਂ ਕਮੀਜਾਂ ਜਾਂ ਪੈਂਟਾਂ ਦਾ ਇਸਤੇਮਾਲ ਕਰੀਏ ਅਸੀਂ ਆਪਣੇ ਘਰ ਦੇ ਵਿੱਚ ਜਾਂ ਦਫ਼ਤਰ ਦੇ ਵਿੱਚ ਮਸਕੀਟੋ ਰੈਪਲੈਂਟ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਖਾਣ ਪਾਉਣ ਦੀਆਂ ਚੀਜ਼ਾਂ ਸਾਨੂੰ ਢੱਕ ਕੇ ਰੱਖਣੀਆਂ ਚਾਹੀਦੀਆਂ ਹਨ ਆਪਣੇ ਆਸ ਪਾਸ ਦੀ ਸਾਫ਼ ਸਫਾਈ ਦਾ ਵੀ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਡੇਂਗੂ ਬੁਖਾਰ ਆਮ ਤੌਰ 'ਤੇ ਠਹਿਰੇ ਹੋਏ ਪਾਣੀ ਤੋਂ ਇਸ ਤੋਂ ਕੱਟਣ ਵਾਲਾ ਮੱਛਰ ਜਿਹੜਾ ਹੈ ਠਹਿਰੇ ਹੋਏ ਪਾਣੀ ਤੋਂ ਪੈਦਾ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਦਫ਼ਤਰ ਵਿੱਚ ਜਾਂ ਘਰ ਦੇ ਆਸ ਪਾਸ ਦੀਆਂ ਥਾਵਾਂ 'ਤੇ ਪਾਣੀ ਜਮਾਂ ਨਾ ਹੋਣ ਦੇਈਏ ਪੁਰਾਣੇ ਟਾਇਰਾਂ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਪਾਣੀ ਨਾ ਇਕੱਠਾ ਹੋਣ ਦੇਈਏ ਮੱਛਰਾਂ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਅਸੀਂ ਮੱਛਰਦਾਨੀ ਦਾ ਇਸਤੇਮਾਲ ਕਰੀਏ ਜਾਂ ਮੱਛਰ ਨੂੰ ਭਜਾਉਣ ਵਾਲੀ ਕਰੀਮ ਨੂੰ ਦਾ ਇਸਤੇਮਾਲ ਕਰੀਏ ਅਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਆਪਣੇ ਆਪ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਅ ਸਕਦੇ ਹਾਂ ਆਪਣੇ ਖਾਣ ਪੀਣ ਦਾ ਆਪਣੇ ਆਸ ਪਾਸ ਦੀ ਸਾਫ਼ ਸਫਾਈ ਦਾ ਧਿਆਨ ਰੱਖ ਕੇ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਇਹਨਾਂ ਖਤਰਨਾਕ ਬਿਮਾਰੀਆਂ ਤੋਂ ਬਚਾ ਸਕਦੇ ਹਾਂ